ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਇੱਕ ਆਪਾਂ ਜੀ ਪੰਦਰਾਂ ਹਜ਼ਾਰ ਰੁਪਏ ਲੈਂਦੇ ਪਰ ਮੰਨਥ ਜੀ ਜੇ ਪੇਪਰ ਭਰਨਾ ਤਾਂ ਵੀਹ ਹਜ਼ਾਰ ਜੀ ਹਾਂਜੀ ਨਹੀਂ ਇਹ ਆਪਣਾ ਚੰਡੀਗੜ੍ਹ ਹੈ ਜੀ ਹਾਂਜੀ ਹਾਂਜੀ ਆਪਾਂ ਜੀ ਛੇ ਸੈਕਟਰ ਹਾਂਜੀ ਹਾਂਜੀ ਸਾਡੇ ਦੇਖੋ ਬੈਂਡ ਦੀ ਤਾਂ ਹੁਣ ਤੁਹਾਡੀ ਮਿਹਨਤ 'ਤੇ ਪਤਾ ਲੱਗੁੁੂਗਾ ਜੀ ਆਪਣੀ ਫੁੱਲ ਗਰੰਟੀ ਹੈ ਜੀ ਵੀਜ਼ੇ ਦੀ

ਟਾਈਮ ਤਾਂ ਵੈਸੇ ਭਾਜੀ ਅਸੀਂ ਦੋ ਮੰਨਥ ਤੱਕ ਰੱਖਦੇ ਬਾਕੀ ਜੇ ਤੁਹਾਡੀ ਇੱਛਾ ਹੋਵੇ ਵੱਧ ਲਾਉਣ ਦੀ ਤਾਂ ਤੁਹਾਡੀ ਮਰਜ਼ੀ ਹੈ ਜੀ

ਤਾਂ ਆਪਾਂ ਜੀ ਲੈ ਕੇ ਛੇ ਵਜੇ ਤੋਂ ਲੈ ਕੇ ਦੋ ਵਜੇ ਤੱਕ ਹਾਂਜੀ ਹਾਂਜੀ ਹਾਂਜੀ ਹਾਂ ਅਸੀਂ ਆਪ ਲਗਵਾਉੂਂਗੇ ਜੀ ਓਕੇ ਜੀ ਓਕੇ